ਹੈਲੋ ਕੀ ਤੁਸੀਂ ਮਹਿਤਾ ਟਰੈਵਲ ਏਜੰਸੀ ਤੋਂ ਗੱਲ ਕਰ ਰਹੇ ਹੋ ਮੈਂ ਰੋਪੜ ਤੋਂ ਰਾਹੀਲਮਸੀ ਬੋਲ ਰਹੀ ਹਾਂ ਅਤੇ ਮੈਂ ਆਪਣੇ ਪਰਿਵਾਰ ਨਾਲ ਸ਼ਿਮਲੇ ਘੁੰਮਣ ਜਾਣਾ ਚਾਹੁੰਦੀ ਹਾਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਡੇ ਤੁਹਾਡੇ ਕੈਬਾਂ ਦੀ ਕੀਮਤ ਕਿਆ ਹੈ ਚਾਰ ਲੋਕਾਂ ਨੂੰ ਫਿੱਟ ਬੈਠਣ ਵਾਲੀ ਕੈਬਾਂ ਦੀ ਕੀਮਤ ਅਤੇ ਛੇ ਲੋਕਾਂ ਨੂੰ ਫਿੱਟ ਬੈਠਣ ਵਾਲੀ ਕੈਬਾਂ ਦੀ ਕੀਮਤ ਕੀ ਹੋਵੇਗੀ